ਗੁਰਦਾਸਪੁਰ ਜ਼ਿਲ੍ਹੇ ਵਿੱਚ ਪਲਾਸਟਿਕ ਦਾ ਲੋਕ ਬਹੁਤ ਜ਼ਿਆਦਾ ਯੂਜ ਕਰਦੇ ਹਨ ਪੋਲੀਥੀਨ ਦਾ ਉਹ ਜੋ ਕਿ ਵਾਤਾਵਰਨ ਨੂੰ ਬਹੁਤ ਪ੍ਰਦੂਸ਼ਿਤ ਕਰਦਾ ਹੈ ਅੱਜ ਕੱਲ੍ਹ ਲੋਕ ਨਹਿਰਾਂ ਦੇ ਵਿੱਚ ਵੀ ਕਚਰਾ ਸੁੱਟੀ ਜਾਂਦੇ ਹਨ ਅਸੀਂ ਇਸ ਵਾਸਤੇ ਪਹਿਲ ਕਦਮੀ ਇਹ ਕਰ ਰਹੇ ਹਾਂ ਕਿ ਜੋ ਵੀ ਲੋਕ ਨਹਿਰਾਂ ਦੇ ਵਿੱਚ ਕਚਰਾ ਸੁੱਟਦੇ ਹਨ ਉਹਨਾਂ ਨੂੰ ਰੋਕਦੇ ਹਾਂ ਅਤੇ ਉਹਨਾਂ ਨੂੰ ਜਾਗਰੂਤ ਕਰਦੇ ਹਾਂ ਕਿ ਨਹਿਰਾਂ ਵਿੱਚ ਕਚਰਾ ਨਾ ਸੁੱਟਿਆ ਜਾਵੇ ਔਰ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਅਸੀਂ ਖੁਦ ਵੀ ਵੱਧ ਤੋਂ ਵੱਧ ਰੁੱਖ ਆਪਣੇ ਖੇਤ ਦੇ ਚਾਰ ਚੁਫੇਰੇ ਲਗਾਏ ਹੋਏ ਹਨ ਅਤੇ ਲੋਕਾਂ ਨੂੰ ਵੀ ਜਾਗਰੂਕ ਕਰਦੇ ਹਾਂ ਕਿ ਵੱਧ ਤੋਂ ਵੱਧ ਰੁੱਖ ਲਗਾਓ ਸਾਡਾ ਜਿਲ੍ਹਾ ਬਹੁਤ ਵਧੀਆ ਪਹਾੜੀ ਖੇਤਰ ਦੇ ਨਾਲ ਦਾ ਜਿਲ੍ਹਾ ਹੈ ਇੱਥੋਂ ਦੇ ਜ਼ਮੀਨ ਬਹੁਤ ਜ਼ਿਆਦਾ ਉਪਜਾਊ ਹੈ ਇੱਥੇ ਬਾਰਿਸ਼ ਵੀ ਤਕਰੀਬਨ ਹੋਰ ਜ਼ਿਲ੍ਹਿਆਂ ਨਾਲੋਂ ਵਧੇਰੇ ਹੁੰਦੀ ਹੈ ਔਰ ਜ਼ਮੀਨ ਸਾਡੀ ਬਹੁਤ ਉਪਜਾਊ ਹੈ ਇਸ ਉੱਤੇ ਧਿਆਨ ਦੇਣ ਦੀ ਲੋੜ ਹੈ ਔਰ ਅਸੀਂ ਲੋਕਾਂ ਨੂੰ ਵੀ ਵੱਧ ਤੋਂ ਵੱਧ ਜਾਗਰੂਕ ਕਰਦੇ ਹਾਂ ਕਿ ਇਸ ਪਾਸੇ ਵੱਲ ਆ ਕੇ ਇਸ ਵੱਲ ਧਿਆਨ ਦਿੱਤਾ ਜਾਵੇ